ਹੈਲੋ ਹਾਂਜੀ ਹਾਂ ਬੀਜ ਦਾ ਯਾਰ ਵਿੱਚੇ ਤਾਂ ਇੱਕ ਸੌ ਛੱਬੀ ਆਖੀ ਜਾਂਦੇ ਨੇ ਵਿੱਚੇ ਉਹ ਪੀ ਆਰ ਇੱਕ ਸੌ ਅਠਾਈ ਲਾਈ ਜਾਂਦੇ ਨਾ ਵੇਖ ਲੈ ਕਿਹੜਾ ਲਾਗੇ ਅਤੇ ਹਾਂ ਵੱਧ ਹੁੰਦਾ ਹਾਂ ਅਤੇ ਐਤਕੀ ਕਿਹੜਾ ਲਾਈਏ ਫੇਰ ਹਾਂ ਅੱਡ ਅੱਡ ਲਾਉਣੇ ਚਾਹੀਦੇ ਹੈ ਹਾਂ ਇਹ ਤਾਂ ਹੈ ਹੀ ਹਾਂ ਇੱਕ ਸੌ ਅਠਾਈ ਵੀ ਖਰਾਬ ਹੋ ਗਈ ਸੀ ਐਤਕੀ ਹੁਣ ਪਨੀਰੀਆਂ ਨਹੀਂ ਪਹਿਲੀ ਗੱਲ ਤਾਂ ਤਿਆਰ ਹੋ ਰਹੀਆਂ ਗਰਮੀ ਬਾਹਲੀ ਹੈ ਹਾਂ ਇਹ ਤਾਂ ਹੈ ਹਾਂ ਇੱਕ ਸੌ ਛੱਬੀ ਲਾ ਲੈਂਦੇ ਹਾਂ

ਦੋ ਸੌ ਹਾਂ ਇਹ ਤਾਂ ਹੈ ਹੀ ਫੇਰ ਐਂ ਵੀ ਇੱਕ ਸੌ ਬਾਰਾਂ ਦੋ ਸੌ ਬਾਰਾਂ ਵੀ ਲਾ ਲਵਾਂਗੇ ਇੱਕ ਸੌ ਛੱਬੀ ਵੀ ਲਾ ਲਵਾਂਗੇ ਫੇਰ ਉਹ ਹਾਂ ਇਹ ਤਾਂ ਠੀਕ ਹੈ ਬੀਜ ਦਾ ਕਿਵੇਂ ਕਰਾਂਗੇ ਬੀਜ ਤਾਂ ਲਿਆਉਣਾ ਹੀ ਪਊ ਫੇਰ ਫੇਰ ਠੀਕ ਹੈ ਚਲੋ ਠੀਕ

ਠੀਕ ਹੈ ਦੋ ਕਿੱਲਿਆਂ ਦਾ ਜਾਂ ਕਿਲ ਦੋ ਕੁ ਕਿੱਲਿਆਂ ਦਾ

ਠੀਕ ਹੈ

ਨਹੀਂ ਵੀ ਲੈਂਦਾ ਦ ਤਿੰਨ ਚਾਰ ਤਾਂ ਵਰਾਇਟੀਆਂ ਮੈਂ ਤਾਂ ਬੈਨ ਹੀ ਕਰ ਰੱਖੀਆਂ ਹਾਂ ਮੈਂ ਦੇਖਿਆ ਨਹੀਂ ਸੁਣਿਆ ਹੀ ਸੀ ਮੈਂ ਤਾਂ ਪਿੰਡ 'ਚ ਆਇਆ ਸੀਗਾ ਸੁਣਿਆ ਸੀ ਵੀ ਯਾਰ ਦੋ ਤਿੰਨ ਵਰਾਈਟੀਆਂ ਐਤਕੀ ਬੈਨ ਕਰਤੀਆਂ ਸਰਕਾਰ ਨੇ

ਠੀਕ

ਠੀਕ ਹੈ ਠੀਕ ਠੀਕ ਹੈ ਚੰਗਾ ਬਾਈ ਚੰਗਾ ਸਤਿ ਸ਼੍ਰੀ ਅਕਾਲ ਜੀ